ਹਾਂ ਮੈਂ ਆਪਣੇ ਇਤਿਹਾਸ ਵਿੱਚ ਆਪਣੇ ਖੇਤਰ ਅਤੇ ਆਪਣੇ ਦੁਆਲੇ ਆਲੇ ਦੁਆਲੇ ਦੇ ਖੇਤਰਾਂ ਦੇ ਵਿਵਾਦ ਬਾਰੇ ਬਹੁਤ ਕੁਝ ਸੁਣਿਆ ਹੈ ਜਿਵੇਂ ਕਿ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੇ ਵਿੱਚ ਆਇਆ ਉਸ ਦਾ ਮਨਸੂਬਾ ਪੰਜਾਬ ਦੀ ਹਕੂਮਤ ਪੰਜਾਬ ਦੇ ਪਾਣੀ ਪੰਜਾਬ ਦੀ ਜ਼ਮੀਨ ਜ਼ਮੀਨ ਦੇ ਉੱਪਰ ਕਬਜ਼ਾ ਕਰਨਾ ਸੀ ਅਤੇ ਇੱਥੋਂ ਭਾਰਤ ਦੇ ਮੰਦਰਾਂ ਦੇ ਵਿੱਚ ਪਿਆ ਸੋਨਾ ਜਾਂ ਚਾਂਦੀ ਲੁੱਟ ਕੇ ਆਪਣੇ ਮੁਲਕ ਲੈ ਜਾਣਾ ਚਾਹੁੰਦਾ ਸੀ ਔਰ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਵੀ ਉਹ ਆਪਣਾ ਲ ਲੀ ਕੇ ਅਤੇ ਆਪਣਾ ਉੱਥੇ ਜਿਸਮ ਦੀਆਂ ਮੰਡੀਆਂ ਵਿੱਚ ਵੇਚਦਾ ਸੀ ਅਤੇ ਇਸ ਤਰ੍ਹਾਂ ਤੈਮੂਰ ਲੰਗ ਹੋਇਆ ਇਸ ਤਰ੍ਹਾਂ ਇੱਕ ਹੋਰ ਵੀ ਕਈ ਹਮਲਾਵਰ ਹੋਏ ਹਨ ਜਿਨ੍ਹਾਂ ਨੇ ਸਾਡੇ ਇਸ ਖੇਤਰ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪਰ ਉਸ ਨੂੰ ਟੱਕਰ ਦੇਣ ਵਾਸਤੇ ਕਈ ਜੰਗਜੂ ਕਈ ਬਹਾਦਰਾਂ ਨੇ ਉਹਨਾਂ ਦੇ ਦੰਦ ਖੱਟੇ ਕੀਤੇ ਅਤੇ ਉਹਨਾਂ ਨੂੰ ਇੱਥੋਂ ਭਜਾਇਆ